ਹਾਂਜੀ ਮੇਰੇ ਘਰ ਵਿੱਚ ਇੱਕ ਬਹੁਤ ਸੋਹਣਾ ਬਾਗ ਹੈ ਜਿਹਦੇ ਵਿੱਚ ਮੈਂ ਤਰ੍ਹਾਂ ਤਰ੍ਹਾਂ ਦੇ ਪੌਦੇ ਰੁੱਖ ਲਗਾਏ ਹੋਏ ਹਨ ਜਿਹਦੇ ਵਿੱਚ ਮੈਂ ਸਬਜ਼ੀਆਂ ਫਲ ਪੌਦੇ ਵੱਖਰੇ ਵੱਖਰੇ ਲਗਾਏ ਹੋਏ ਹਨ ਜਿਵੇਂ ਸਬਜ਼ੀਆਂ ਮੇਰੀ ਮਨ ਪਸੰਦ ਦੀਆਂ ਨੇ ਜਿਵੇਂ ਕਿ ਭਿੰਡੀਆਂ ਟੀਂਡੇ ਕਰੇਲੇ ਕਾਲੀ ਤੋਰੀ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਕਿ ਮੇਰੇ ਮਨ ਪਸੰਦ ਹਨ ਜਦੋਂ ਇਹ ਸਬਜ਼ੀਆਂ ਖਿੜਦੀਆਂ ਹਨ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਜ ਜੋ ਕਿ ਮੇਰੀਆਂ ਮਨ ਪਸੰਦ ਵੀ ਹਨ ਜਦੋਂ ਮੇਰਾ ਦਿਲ ਕਰਦਾ ਹੈ ਮੈਂ ਬਣਾਉਂਦੀ ਵੀ ਹਾਂ ਅਤੇ ਮੈਂ ਖਾਂਦੀ ਵੀ ਹਾਂ ਹੁਣ ਦੂਸਰੇ ਪਾਸੇ ਆਉਂਦਾ ਹੈ ਫਲ ਜੋ ਕਿ ਮੇਰੇ ਮਨ ਪਸੰਦ ਨੇ ਜਿਵੇਂ ਅੰਗੂਰ ਸੰਗਤਰੇ ਅੰਬ ਹੋਰ ਵੀ ਬਹੁਤ ਸਾਰੇ ਫਲ ਲਗਾਏ ਹੋਏ ਨੇ ਜਦੋਂ ਇਹ ਖਿੜਦੇ ਨੇ ਬਹਾਰ ਦੇ ਅਨੁਸਾਰ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਹੋਰ ਵੀ ਮੈਂ ਬਹੁਤ ਸਾਰੇ ਫੁੱਲ ਲਗਾਏ ਹੋਏ ਨੇ ਆਪਣੇ ਬਾਗ ਵਿੱਚ ਜੋ ਕਿ ਬਹਾਰ ਅਨੁਸਾਰ ਖਿੜਦੇ ਹਨ ਜਿਹੜੇ ਬਹਾਰ ਵਿੱਚ ਜਿਹੜਾ ਫੁੱਲ ਖਿੜਦਾ ਹੈ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਮੇਰਾ ਬਗੀਚਾ ਹਰਿਆ ਭਰਿਆ ਹੈ ਜਿਹਨੂੰ ਦੇਖ ਕੇ ਮੈਂ ਬਹੁਤ ਹੀ ਖੁਸ਼ ਹੁੰਦੀ ਹਾਂ ਅਤੇ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਸਾਰੀਆਂ ਸਬਜ਼ੀਆਂ ਵੀ ਮੇਰੀਆਂ ਮਨ ਪਸੰਦ ਨੇ ਫਲ ਵੀ ਮੇਰੇ ਮਨ ਪਸੰਦ ਨੇ ਜਦੋਂ ਮੇਰਾ ਦਿਲ ਕਰਦਾ ਹੈ ਮੈਂ ਖਾਂਦੀ ਵੀ ਹਾਂ ਅਤੇ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹਾਂ ਧੰਨਵਾਦ